ਇੰਟਰਨੈਟ ਨੇ ਗੇਮਾਂ ਦੀ ਧਾਰਨਾ ਨੂੰ ਬਹੁਤ ਬਦਲ ਦਿੱਤਾ ਹੈ ਬੱਚੇ ਅੱਜ ਕੱਲ੍ਹ ਵੀਡੀਓ ਗੇਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਿਸ ਨਾਲ ਸਰੀਰਕ ਗਤੀਵਿਧੀਆਂ ਵਿੱਚ ਕਮੀ ਆ ਚੁੱਕੀ ਹੈ ਅਤੇ ਰਵਾਇਤੀ ਆਊਟਡੋਰ ਖੇਡਾਂ ਵਿੱਚ ਵੀ ਬਹੁਤ ਗਿਰਾਵਟ ਆਈ ਹੈ ਇੰਟਰਨੈਟ ਨੇ ਗੇਮਿੰਗ ਨੂੰ ਵਧੇਰੇ ਪਹੁੰਚ ਯੋਗ ਬਣਾ ਦਿੱਤਾ ਹੈ ਜਿਸ ਵਿੱਚ ਬੱਚੇ ਪਬਜੀ ਫਰੀ ਫਾਇਰ ਅਤੇ ਫੀਫਾ ਮੋਬਾਈਲ ਵਰਗੀਆਂ ਮੋਬਾਈਲ ਗੇਮਾਂ ਉੱਤੇ ਘੰਟੇ ਬਿਤਾਉਂਦੇ ਹਨ ਮੁਕਾਬਲੇਬਾਜ ਈ ਸਪੋਰਟ ਟੂਰਨਾਮੈਂਟ ਨੂੰ ਲਾਭਕਾਰੀ ਇਨਾਮਾਂ ਦੀ ਪੇਸ਼ਕਸ਼ ਵੀ ਕਰਦੇ ਹਨ ਜਿਸ ਨਾਲ ਗੇਮਿੰਗ ਇੱਕ ਗੰਭੀਰ ਕੈਰੀਅਰ ਵਿਕਲਪ ਬਣਦਾ ਜਾ ਰਿਹਾ ਹੈ ਵਧੇਰੇ ਬੱਚੇ ਫੁਟਬਾਲ ਕ੍ਰਿਕਟ ਜਾਂ ਬਾਸਕਟਬਾਲ ਵਰਗੀਆਂ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਬਜਾਏ ਘਰ ਦੇ ਅੰਦਰ ਖੇਡਣਾ ਪਸੰਦ ਕਰਦੇ ਹਨ ਆਊਟਡੋਰ ਗੇਮਾਂ ਪ੍ਰਸਿੱਧੀਆਂ ਗਵਾ ਰਹੀਆਂ ਹਨ ਕਿਉਂਕਿ ਬੱਚੇ ਖੇਡ ਦੇ ਮੈਦਾਨਾਂ ਦੀ ਬਜਾਏ ਆਨਲਾਈਨ ਵਧੇਰਾ ਸਮਾਂ ਬਿਤਾਉਂਦੇ ਹਨ ਇਸ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਜਿਵੇਂ ਕਿ ਕਸਰਤ ਦੀ ਕਮੀ ਕਾਰਨ ਮੋਟਾਪੇ ਅਤੇ ਕਮਜ਼ੋਰ ਮਾਸਪੇਸ਼ੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਸਕਰੀਨ ਟਾਈਮ ਤੋਂ ਪੋਸਚਰ ਦੀ ਸਮੱਸਿਆਵਾਂ ਅਤੇ ਅੱਖਾਂ ਦਾ ਵੀ ਤਨਾਵ ਵੱਧਦਾ ਜਾ ਰਿਹਾ ਹੈ ਬੱਚਿਆਂ ਵਿੱਚ ਆਊਟਡੋਰ ਖੇਡਣ ਵਾਲੇ ਬੱਚਿਆਂ ਦੇ ਮੁਕਾਬਲੇ ਮਾੜਾ ਸਟੈਮਿਨਾ ਅਤੇ ਤੰਦਰੁਸਤੀ ਦੇ ਵਿੱਚ ਵੀ ਗਿਰਾਵਟ ਆ ਰਹੀ ਹੈ ਗੇਮਿੰਗ ਦੀ ਆਦਤ ਪੜ੍ਹਾਈ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਸਮਾਜਿਕ ਹੁਨਰ ਘੱਟਦੇ ਜਾ ਰਹੇ ਹਨ ਕਿਉਂਕਿ ਬੱਚੇ ਅਸਲ ਜ਼ਿੰਦਗੀ ਨਾਲੋਂ ਵਰਚੁਅਲ ਸੰਸਾਰ ਵਿੱਚ ਵਧੇਰੇ ਗੱਲਬਾਤ ਕਰਦੇ ਹਨ ਆਨਲਾਈਨ ਗੇਮਾਂ ਵਿੱਚ ਨਿਰੰਤਰ ਮੁਕਾਬਲੇ ਦੇ ਕਾਰਨ ਤਨਾਅ ਅਤੇ ਚਿੰਤਾ ਵਿੱਚ ਵਾਧਾ ਹੋ ਰਿਹਾ ਹੈ ਇੰਟਰਨੈਟ ਨੇ ਗੇਮਿੰਗ ਅਤੇ ਖੇਡਾਂ ਵਿੱਚ ਕ੍ਰਾਂਤੀ ਤਾਂ ਲਿਆ ਦਿੱਤੀ ਹੈ ਜਿਸ ਨਾਲ ਬੱਚਿਆਂ ਲਈ ਵਰਚੁਅਲ ਖੇਡ ਵਧੇਰੇ ਆਕਰਸ਼ਕ ਬਣ ਗਈ ਹੈ ਹਾਲਾਂਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਸਰੀਰਕ ਗਤੀਵਿਧੀਆਂ ਸਮੁੱਚੇ ਵਿਕਾਸ ਲਈ ਉਹਨਾਂ ਦਾ ਰੂਟੀਨ ਦਾ ਹਿੱਸਾ ਬਣੇ ਰਹਿਣ ਆਨਲਾਈਨ ਗੇਮਿੰਗ ਅਤੇ ਆਊਟਡੋਰ ਖੇਡਾਂ ਦਾ ਸੁਮੇਲ ਬੱਚਿਆਂ ਲਈ ਸੰਤੁਲਿਤ ਸਿਹਤਮੰਦ ਜੀਵਨ ਸ਼ੈਲੀ ਬਣਾ ਸਕਦਾ ਹੈ